ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਇੰਦਰਜੀਤ ਸਿੰਘ ਪਲੰਬਰ ਬੋਲਦੇ ਹੋ ਮੈਨੂੰ ਹੈ ਨਾ ਮੇਰੀ ਗਵਾਂਢਣ ਨੇ ਤੁਹਾਡਾ ਨੰਬਰ ਦਿੱਤਾ ਸੀ ਜੀ ਮੇਰੇ ਘਰ ਦੇ ਬਾਥਰੂਮ ਦੀਆਂ ਟੂਟੀਆਂ ਲੀਕ ਹੋ ਰਹੀਆਂ ਹੈ ਔਰ ਕੁਝ ਵਿੱਚ ਪਾਣੀ ਵੀ ਨਹੀਂ ਆ ਰਿਹਾ ਚੰਗੀ ਤਰ੍ਹਾਂ

ਹਾਂਜੀ ਮੈਂ ਕੁਰਾਲੀ ਦੇ ਪਿੰਡ ਚਨਾਲੋ ਤੋਂ ਬੋਲ ਰਹੀ ਹਾਂ ਨੇੜੇ ਹੀ ਪਿੰਡ ਹੈ ਜੀ ਕੁਰਾਲੀ ਤੋਂ ਹਾਂਜੀ ਕਿਆ ਤੁਸੀਂ ਟੁੱਟੀਆਂ ਠੀਕ ਕਰਨ ਲਈ ਅੱਜ ਆ ਸਕਦੇ ਹੋ ਹਾਂਜੀ ਦੇਖ ਲਓ ਅਗਰ ਅੱਜ ਆ ਸਕਦੇ ਹੋ ਤਾਂ ਹਾਂਜੀ ਫਿਰ ਕੱਲ੍ਹ ਤਾਂ ਅਗਰ ਅੱਜ ਤੁਸੀਂ ਨਹੀਂ ਆ ਸਕਦੇ ਕੱਲ੍ਹ ਪੱਕਾ ਆ ਜਾਓ ਜੀ ਫਿਰ ਟਾਈਮ 'ਤੇ ਹਾਂਜੀ ਠੀਕ ਹੈ ਓਕੇ ਫਿਰ